ਮੈਂ ਮਟਰਾਂ ਦੀ ਸਬਜ਼ੀ ਬਣਾਈ ਸੀ ਸਭ ਤੋਂ ਪਹਿਲਾਂ ਤਾਂ ਮਟਰ ਛਿੱਲੇ ਫਿਰ ਉਹਨਾਂ ਨੂੰ ਪਾਣੀ ਨਾਲ ਧੋਤਾ ਫਿਰ ਉਹਨਾਂ ਦਾ ਮਸਾਲਾ ਤਿਆਰ ਕੀਤਾ ਗੰਢੇ ਹਰੀ ਮਿਰਚ ਲਾਲ ਮਿਰਚ ਫਿਰ ਲਸਣ ਅਦਰਕ ਇਹ ਮਸਾਲਾ ਤਿਆਰ ਕੀਤਾ ਫਿਰ ਉਹਨਾਂ ਨੂੰ ਤੜਕਾ ਲਾਇਆ ਇੱਕ ਪਤੀਲੀ ਵਿੱਚ ਮੈਂ ਘਿਓ ਪਾਇਆ ਫਿਰ ਉਹਨਾਂ ਨੂੰ ਤੜਕਾ ਲਾਇਆ ਲੂਣ ਮਿਰਚ ਮਸਾਲਾ ਹਲਦੀ ਆਪਣੇ ਸਵਾਦ ਅਨੁਸਾਰ ਪਾਇਆ ਅਤੇ ਉਹ ਮਟਰਾਂ ਦੀ ਸਬਜ਼ੀ ਮੈਂ ਬਣਾ ਲਈ ਪਰ ਉਸ ਮਟਰਾਂ ਦੀ ਸਬਜ਼ੀ ਜਦੋਂ ਮੈਂ ਟੇਸਟ ਕੀਤੀ ਉਹਦੇ ਵਿੱਚ ਮੈਨੂੰ ਮਿਰਚ ਜ਼ਿਆਦਾ ਲੱਗੀ ਇਸ ਲਈ ਮੈਂ ਉਹਨੂੰ ਮਤਲਬ ਵੇਸਟ ਨਹੀਂ ਕਰ ਸਕਦੀ ਸੀ ਉਹਨੂੰ ਸੁੱਟ ਨਹੀਂ ਸਕਦੀ ਮੈਂ ਕੀ ਕੀਤਾ ਮੈਂ ਆਲੂ ਲਏ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਫਿਰ ਉਹਨਾਂ ਨੂੰ ਉਬਾਲ ਲਿਆ ਉਬਾਲ ਕੇ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਿਆ ਫਿਰ ਮੈਂ ਉਹ ਸਬਜ਼ੀ ਵਿੱਚ ਉਹਨਾਂ ਨੂੰ ਪਾ ਦਿੱਤਾ ਇਸ ਨਾਲ ਉਹਦੀ ਮਿਰਚ ਘੱਟ ਗਈ ਅਤੇ ਇੱਕ ਮਿਰਚ ਘਟਾਉਣ ਲਈ ਮੈਂ ਇੱਕ ਇਹ ਵੀ ਕਰ ਸਕਦੀ ਹਾਂ ਕਿ ਮੈਂ ਉਹਦੇ ਵਿੱਚ ਨਮਕ ਪਾ ਸਕਦੀ ਹਾਂ ਜੇ ਮੈਨੂੰ ਫਿਰ ਵੀ ਲੱਗਦਾ ਅਤੇ ਮੈਂ ਉਹਦੇ ਵਿੱਚ ਦੁੱਧ ਐਡ ਕਰ ਸਕਦੀ ਹਾਂ ਦੁੱਧ ਵਿੱਚ ਪਾ ਕੇ ਇੱਕ ਤਾਂ ਉਹਦਾ ਜਿਹੜਾ ਲੂਣ ਮਿਰਚ ਆ ਉਹ ਜਮਾਂ ਸਹੀ ਹੋ ਜਾਂਦਾ ਨਾ ਜ਼ਿਆਦਾ ਨਾ ਘੱਟ ਇੱਕ ਉਹ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਉਹਦਾ ਸਵਾਦ ਬਦਲ ਜਾਂਦਾ ਅਤੇ ਆਲੂ ਮਟਰਾਂ ਦੀ ਸਬਜ਼ੀ ਇੰਨੀ ਜ਼ਿਆਦਾ ਵਧੀਆ ਬਣਦੀ ਆ ਦੁੱਧ ਪਾਉਣ ਨਾਲ ਕਿ ਮਤਲਬ ਬਹੁਤ ਜ਼ਿਆਦਾ ਵਧੀਆ